ਇਹ ਯਕੀਨੀ ਬਣਾਉਣ ਲਈ ਕਿ ਨਵੇਂ ਜਨਮੇ ਬੱਚਿਆਂ ਨੂੰ ਵਾਤਾਵਰਣ ਸਵੱਚ ਮਿਲੇ ਪਹਿਲਾਂ ਤਾਂ ਉਹਨਾਂ ਦੇ ਆਲੇ ਦੁਆਲੇ ਨੂੰ ਸਾਫ ਰੱਖਿਆ ਜਾਵੇ ਉਹਨਾਂ ਦੇ ਕੱਪੜੇ ਸਾਫ ਸੁਥਰੇ ਹੋਣ ਤੇ ਅਤੇ ਉਹਨਾਂ ਦਾ ਨਾਲ ਹੀ ਨਾਲ ਪੂਰਾ ਧਿਆਨ ਰੱਖਿਆ ਜਾਵੇ ਉਹਨਾਂ ਨੂੰ ਨਵਾਇਆ ਜਾਵੇ ਚੰਗੀ ਤਰ੍ਹਾਂ ਠੀਕ ਹੈ ਉਹਨਾਂ ਲਈ ਜੋ ਬਿਹਤਰ ਹੈ ਉਹਨਾਂ ਨੂੰ ਉਹੀ ਚੀਜ਼ ਦਿੱਤੀ ਜਾਵੇ ਅਤੇ ਉਹੀ ਉਹਨਾਂ ਲਈ ਵਰਤੀ ਜਾਵੇ ਇਸ ਤੋਂ ਇਲਾਵਾ ਜੇ ਅਸੀਂ ਚਾਹੁੰਦੇ ਹਾਂ ਕਿ ਬੱਚੇ ਸਵੱਛ ਰਹਿਣ ਤਾਂ ਉਹਨਾਂ ਦਾ ਖਾਣ ਪੀਣ ਦਾ ਵੀ ਸਖਤ ਖਿਆਲ ਰੱਖਿਆ ਜਾਵੇ ਅਤੇ ਉਹਨਾਂ ਦਾ ਆਲਾ ਦੁਆਲਾ ਹਮੇਸ਼ਾ ਸਾਫ ਸੁਥਰਾ ਰਹੇ ਅਤੇ ਉਹਨਾਂ ਨੂੰ ਉਹਨਾਂ ਤੋਂ ਜਿਵੇਂ ਘਰ ਵਿੱਚ ਅਸੀਂ ਬੱਚੇ ਜਾਨਵਰ ਪਾਲਦੇ ਹਾਂ ਅਤੇ ਅਸੀਂ ਉਹਨਾਂ ਨੂੰ ਜਾਨਵਰਾਂ ਤੋਂ ਦੂਰ ਰੱਖੀਏ ਉਹਨਾਂ ਦੇ ਵਾਤਾਵਰਨ ਨੂੰ ਪੂਰਾ ਸ਼ੁੱਧ ਬਣਾਈਏ ਅਤੇ ਉਹਨਾਂ ਨੂੰ ਖਾਣ ਪੀਣ ਲਈ ਵਧੀਆ ਦਈਏ ਜਿੰਨਾ ਵਧੀਆ ਤੋਂ ਵਧੀਆ ਅਸੀਂ ਦੇ ਸਕਦੇ ਹਾਂ ਅਤੇ ਉਹਨਾਂ ਨੂੰ ਰੋਜ਼ ਆਪਣਾ ਸਾਫ ਕਰੀਏ ਨਵਾਈਏ ਅਤੇ ਉਹਨਾਂ ਨੂੰ ਜੋ ਉਹਨਾਂ ਦੀ ਬੋਡੀ ਨੂੰ ਰਿਕੁਾਇਰਮੈਂਟ ਚੀਜ਼ ਦੀ ਜ਼ਰੂਰਤ ਹੈ ਉਹ ਉਹਨਾਂ ਨੂੰ ਪ੍ਰਦਾਨ ਕਰੀਏ ਹੁਣ ਤਾਂ ਹੀ ਬੱਚੇ ਸਾਫ ਸੁਥਰੇ ਅਤੇ ਉਹਨਾਂ ਦਾ ਵਾਤਾਵਰਨ ਸਵੱਛ ਰਹਿ ਸਕੇਗਾ